ਖੇਤੀਬਾੜੀ ਦੀ ਸਾਡੇ ਵਾਸਤੇ ਬਹੁਤ ਮਹੱਤਤਾ ਖੇਤੀਬਾੜੀ ਕਰਾਂਗੇ ਕਰਨ ਦੇ ਨਾਲ ਕੁੱਝ ਅਸੀਂ ਫਸਲਾਂ ਉਗਾਉਂਦੇ ਹਾਂ ਕਣਕ ਝੋਨਾ ਕਪਾਹ ਦਾਲਾਂ ਸਬਜ਼ੀਆਂ ਵਗੈਰਾ ਹੀ ਉਗਾਉਂਦੇ ਹਾਂ ਇਹਨਾਂ ਨੂੰ ਵੇਚਦੇ ਹਾਂ ਅਸੀਂ ਘਰ ਵਾਸਤੇ ਵੀ ਰੱਖਦੇ ਹਾਂ ਇਹਨਾਂ ਨੂੰ ਅਸੀਂ ਅੱਗੇ ਵੀ ਵੇਚਦੇ ਆ ਤੋਂ ਹੀ ਇੱਕ ਕਮਾਈ ਵੀ ਕਰਦੇ ਹਾਂ ਇਹਦੇ ਨਾਲ ਅਸੀਂ ਵੱਧ ਤੋਂ ਵੱਧ ਪੈਦਾਵਾਰ ਕਰਦੇ ਹਾਂ ਜਿੰਨਾ ਅਨਾਜ ਪੈਦਾ ਕਰਾਂਗੇ ਉਹਦੀ ਅਗਾਂਹ ਸਰਕਾਰਾਂ ਤੱਕ ਪਹੁੰਚਾਉਂਦੇ ਹਾਂ ਸਰਕਾਰ ਲੋੜਵੰਦ ਲੋੜ ਦੇ ਅਨੁਸਾਰ ਆਪਣੇ ਜੋਗਾ ਰੱਖ ਕੇ ਅੱਗੇ ਵੇਚਦੀ ਸਾਡਾ ਦੇਸ਼ ਤਰੱਕੀ 'ਚ ਜਾਂਦਾ ਬਾਹਰਲੀਆਂ ਕੰਟਰੀਆਂ ਨੂੰ ਜਿੱਥੇ ਇਹ ਚੀਜ਼ਾਂ ਨਹੀਂ ਮਿਲਦੀਆਂ ਜਿਨਾਂ ਨੂੰ ਉਹਨਾਂ ਨੂੰ ਪ੍ਰੋਵਾਈਡ ਕਰਦੇ ਇੱਥੋਂ ਦਿੰਦੇ ਉਹਨਾਂ ਨੂੰ ਭੇਜਦੇ ਹਾਂ ਇੱਥੋਂ ਅਸ ਅਸੀਂ ਤਰੱਕੀ ਕਰਦੇ ਹਾਂ ਸਰਕਾਰ ਵੀ ਤਰੱਕੀ ਕਰਦੀ ਹੈ ਅਸੀਂ ਵੀ ਤਰੱਕੀ ਕਰਦੇ ਹਾਂ ਅਤੇ ਬਾਕੀ ਬਹੁਤ ਜ਼ਿਆਦਾਤਰ ਲੋਕ ਇਸ ਇਸ ਤਰੀਕੇ ਨਾਲ ਹੁੰਦੇ ਕਿ ਜਿਵੇਂ ਕਿ ਸ਼ਹਿਰਾਂ ਵਿੱਚ ਜਾ ਕੇ ਵੱਸ ਜਾਂਦੇ ਆ ਕਿ ਸ਼ ਨੌਕਰੀ ਜ਼ਿਆਦਾ ਨੌਕਰੀ ਪੇਸ਼ੇ ਦੇ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਉਲਝਣ ਹੁੰਦੀ ਹੈ ਖੇਤੀ ਦੀ ਉਹ ਫਿਰ ਦੋ ਕੰਮ ਇੱਕ ਵਾਰ ਨਹੀਂ ਕਰ ਸਕਦੇ ਉਹ ਖੇਤੀ ਨਹੀਂ ਨਾਲ ਕਰ ਸਕਦੇ ਕਿਉਂਕਿ ਉਹਨਾਂ ਨੇ ਨੌਕਰੀ ਵੀ ਕਰਨੀ ਹੁੰਦੀ ਹੈ ਇਸ ਕਰਕੇ ਉਹ ਸ਼ਹਿਰ 'ਚ ਚਲੇ ਜਾਂਦੇ ਜਿਹਦੇ ਕਰਕੇ ਉਹ ਖੇਤੀ ਨਹੀਂ ਕਰਦੇ ਅਤੇ ਇਸ ਕਰਕੇ ਜਿਹੜੀ ਆ ਵੀ ਪਰਿਵਾਰ ਜਿਹੜਾ ਆ ਸਾਰਾ ਫਿਰ ਜਿੱਥੇ ਨੌਕਰੀ ਕਰਦੇ ਹੁਣ ਉੱਥੇ ਰਹਿਣ ਲੱਗ ਜਾਂਦਾ ਅਤੇ ਮੇਨ ਬੰਦਾ ਵੀ ਕੋਈ ਜਿਵੇਂ ਅਸੀਂ ਖੇਤੀਬਾੜੀ ਜਿਹੜੇ ਆ ਦੂਜੇ ਬੰਦੇ ਐਸੀ ਖੇਤੀ ਜਿਹੜੀ ਸਾਨੂੰ ਉਹ ਕਰਨੀ ਚਾਹੀਦੀ ਹੈ ਖੇਤੀ ਦੇ ਨਾਲ ਜਿਹੜਾ ਵੀ ਅਸੀਂ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾ ਸਕਦੇ ਹਾਂ